ਪੰਦਰਾਂ ਦਸੰਬਰ ਦੋ ਹਜ਼ਾਰ ਦਸ ਪੰਦਰਾਂ ਅਗਸਤ ਦੋ ਹਜ਼ਾਰ ਚਾਰ ਚੌਦ੍ਹਾਂ ਨਵੰਬਰ ਦੋ ਹਜ਼ਾਰ ਅਠਾਈ ਫਰਵਰੀ ਉੱਨੀ ਸੌ ਸੱਤਰ ਇੱਕ ਸਤੰਬਰ ਉੱਨੀ ਸੌ ਪੰਜਾਹ